ਮੈਨੂੰ ਲੱਗਦਾ ਅੱਜ ਦੇ ਟਾਇਮ ਦੇ ਵਿੱਚ ਵਿਗਿਆਪਨ ਇੱਕ ਬਹੁਤ ਹੀ ਵੱਡਾ ਰੋਲ ਪਲੇ ਕਰਦੇ ਹੈ ਕਿਉਂਕਿ ਤੁਸੀਂ ਕੋਈ ਵੀ ਆਪਣਾ ਪਰੋਡਕਟ ਅਗਰ ਮਾਰਕਿਟ ਦੇ ਵਿੱਚ ਲੋਂਚ ਕਰਨਾ ਹੈ ਓਹਨੂੰ ਵਿਕਰੀ ਵਧਾਉਣੀ ਹੈ ਸੋ ਤੁਹਾਨੂੰ ਇੱਕ ਪ੍ਰਤੀਭਾਸ਼ਾਲੀ ਔਰ ਪ੍ਰਭਾਵਸ਼ਾਲੀ ਵਿਗਿਆਪਨ ਅਗਰ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਆਓਗੇ ਤਾਂ ਤੁਹਾਡੇ ਪ੍ਰੋਡਕਟ ਦੀ ਜੋ ਸੇਲ ਹੈ ਓਹ ਕਾਫੀ ਜ਼ਿਆਦਾ ਹਾਈ ਹੋਵੇਗੀ ਓਰ ਓਹਦੇ ਰਿਵਿਊ ਵੀ ਅੱਛੇ ਹੋਣਗੇ ਸੋ ਰਿਸੈਂਟਲੀ ਮੈਂ ਇੱਕ ਇਸ਼ਤਿਹਾਰ ਦੀ ਗੱਲ ਕਰਦੀ ਹਾਂ ਜਿਵੇਂ ਕਿ ਆਈਫੋਨ ਨੂੰ ਲੈ ਕੇ ਕਾਫੀ ਸਾਰੀਆਂ ਆਰਟੀਕਲਸ ਅਤੇ ਐਡਸ ਦਿੱਤੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਇੰਡੀਆ ਦੇ ਵਿੱਚ ਓਹਦੀ ਵਿੱਕਰੀ ਕਾਫੀ ਜ਼ਿਆਦਾ ਵਧੀ ਹੈ ਸੋ ਇਹ ਸਾਰਾ ਅਸਰ ਜੋ ਹੈ ਵਿਗਿਆਪਨ ਦਾ ਹੀ ਹੈ ਕਿ ਕਿਵੇਂ ਆਈਫੋਨ ਐਪਲ ਕੰਪਨੀ ਜੋ ਹੈ ਓਹ ਆਪਣੇ ਪਰੋਡਕਟਸ ਨੂੰ ਸੇਲ ਕਰਨ ਲਈ ਬਹੁਤ ਹੀ ਵਧੀਆ ਅਤੇ ਪ੍ਰਭਾਵਸ਼ਾਲੀ ਵਿਗਿਆਪਨ ਲੈ ਕੇ ਆਉਂਦੀ ਹੈ ਕਿ ਕਿਵੇਂ ਓਹਨਾ ਦੇ ਫੋਨਸ ਦਾ ਕੈਮਰਾ ਕੈਪਚਰ ਕਰਦਾ ਹੈ ਵਿਡਿਓ ਵਿਡਿਓਸ ਫੋਟੋਸ ਕਿਵੇਂ ਓਹ ਫੋਨ ਕੀ ਹੈ ਤੁਹਾਨੂੰ ਇੱਕ ਸਕਿਓਰੀਟੀ ਪਰੋਵਾਇਡ ਕਰਦਾ ਤੁਹਾਡੇ ਡਾਟਾ ਦੀ ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਕੀ ਹੈ ਤੁਸੀਂ ਆਪਣੇ ਪਰੋਡਕਟ ਨੂੰ ਉਹਦੀ ਸੇਲ ਵਧਾ ਸਕਦੇ ਹੋ ਅਤੇ ਨਾਲ ਦੀ ਨਾਲ ਹੀ ਕੀ ਹੈ ਆਪਣੀ ਕੰਪਨੀ ਨੂੰ ਇੱਕ ਬਹੁਤ ਅੱਛੇ ਮਾਰਕਿਟ ਲੈਵਲ 'ਤੇ ਪੁਚਾ ਸਕਦੇ ਹੋ